ਸਾਡੇ ਜ਼ਿਲ੍ਹੇ ਵਿੱਚ ਬਹੁਤ ਸਾਰੇ ਪੂਜਾ ਸਥਾਨ ਹਨ ਜਿਵੇਂ ਕਿ ਤਰਨਤਾਰਨ ਦਰਬਾਰ ਸਾਹਿਬ ਗੁਰਦੁਆਰਾ ਹੈ ਜੋ ਕਿ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਬਣਾਇਆ ਹੈ ਇੱਥੇ ਬਹੁਤ ਵੱਡਾ ਸਰੋਵਰ ਹੈ ਜੋ ਕਿ ਸਾਰੇ ਇਤਿਹਾਸਿਕ ਸਰੋਵਰਾਂ ਨਾਲੋਂ ਵੱਡਾ ਹੈ ਇੱਥੇ ਹਰ ਮਹੀਨੇ ਮੱਸਿਆ ਅਤੇ ਸੰਗਰਾਂਦ ਮਨਾਈ ਜਾਂਦੀ ਹੈ ਅਤੇ ਹਰ ਸਾਲ ਗੁਰੂ ਅਰਜਨ ਦੇਵ ਜੀ ਦਾ ਗੁਰਪੁਰਬ ਮਨਾਇਆ ਜਾਂਦਾ ਹੈ ਅਤੇ ਇਸਾਈ ਧਰਮਾਂ ਨਾਲ ਸੰਬੰਧਿਤ ਚਰਚ ਵੀ ਹੈ ਜਿਸ ਦਾ ਨਾਂ ਸੰਤ ਥੋਮਸ ਹੈ ਹੈ ਇੱਥੇ ਇਸਾਈ ਭਾਈਚਾਰੇ ਦੇ ਲੋਕ ਇਕੱਠੇ ਹੋ ਕੇ ਯਿਸੂ ਮਸੀਹ ਦੀ ਪੂਜਾ ਕਰਦੇ ਹਨ ਅਤੇ ਉਹਨਾਂ ਦਾ ਤਿਉਹਾਰ ਮਨਾਉਂਦੇ ਹਨ ਅਤੇ ਹੋਰ ਗੁਰੂਆਂ ਨਾਲ ਸੰਬੰਧਿਤ ਲੋਕ ਜਿਵੇਂ ਹਿੰਦੂ ਧਰਮ ਮੁਸਲਮਾਨ ਧਰਮ ਅਤ ਨਾਲ ਸੰਬੰਧਿਤ ਮੰਦਰ ਅਤੇ ਮਸਜ਼ਿਦਾਂ ਹਨ ਉਹ ਵੀ ਹਰ ਸਾਲ ਮੰਦਰ ਵਿੱਚ ਜਨਮ ਅਸ਼ਟਮੀ ਅਤੇ ਸ਼ਿਵਰਾਤਰੀ ਮਨਾਉਂਦੇ ਹਨ ਅਤੇ ਮੁਸਲਮਾਨ ਮਸਜ਼ਿਦ ਵਿੱਚ ਹਜ਼ਰਤ ਮੁਹੰਮਦ ਸਾਹਿਬ ਜੀ ਦਾ ਹਰ ਸਾਲ ਤਿਉਹਾਰ ਮਨਾਉਂਦੇ ਹਨ ਪੱਟੀ ਵਿੱਚ ਪੱਟੀ ਕਿਲ੍ਹਾ ਹੈ ਜੋ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦਾ ਬਣਿਆ ਹੈ ਜੋ ਕਿ ਦੇਖਣਯੋਗ ਹੈ ਅਤੇ ਤਰਨਤਾਰਨ ਜ਼ਿਲ੍ਹੇ ਦੀ ਪਛਾਣ ਹੈ